ਮੇਰਾ ਇਲਾਕਾ ਸ਼ਹੀਦ ਭਗਤ ਸਿੰਘ ਨਗਰ ਹੈ ਇਸ ਇਲਾਕੇ ਦੇ ਵਿੱਚ ਇੱਕ ਬਹੁਤ ਹੀ ਵੱਡੀ ਅਤੇ ਬਹੁਤ ਹੀ ਬਹੁਤ ਸਾਲ ਪੁਰਾਣੀ ਇੱਕ ਬਾਰਾਂਦਰੀ ਗਾਰਡਨ ਹੈ ਜਿਸਦੇ ਬਾਰਾਂ ਦਰਵਾਜ਼ੇ ਹਨ ਪਰ ਲੋਕਾਂ ਨੂੰ ਇਸ ਬਾਗ ਬਾਰੇ ਇਸ ਗਾਰਡਨ ਬਾਰੇ ਬਹੁਤ ਹੀ ਘੱਟ ਪਤਾ ਹੈ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਦੋ ਤਿੰਨ ਜਗ੍ਹਾ ਐਸੀਆਂ ਹਨ ਜਿਨ੍ਹਾਂ ਬਾਰੇ ਸੈਲਾਨੀਆਂ ਨੂੰ ਬਹੁਤ ਹੀ ਘੱਟ ਪਤਾ ਹੈ ਬਾਰਾਂਦਰੀ ਗਾਰਡਨ ਇੱਕ ਬਹੁਤ ਹੀ ਵੱਡੀ ਅਤੇ ਘੁੰਮਣਯੋਗ ਗਾਰਡਨ ਹੈ